ਪੰਜਾਬ ਵਿੱਚ ਪੁਰਾਣੇ ਸਮਿਆਂ ਦੌਰਾਨ ਅਕਸਰ ਹੀ ਬੈਲ ਗੱਡੀਆਂ ਹੀ ਰੱਖੀਆਂ ਜਾਂਦੀਆਂ ਸਨ ਜਿਨ੍ਹਾਂ ਦੇ ਨਾਲ ਹੀ ਸਾਰੇ ਕਾਰਜ ਕੀਤੇ ਜਾਂਦੇ ਸਨ ਇੱਥੋਂ ਤੱਕ ਕਿ ਖੁਸ਼ੀ ਗਮੀ ਵਿਆਹ ਵਗੈਰਾ ਸਾਰਾ ਕੁਛ ਬੈਲ ਗੱਡੀਆਂ ਨਾਲ ਹੀ ਚੱਲਦਾ ਸੀ ਹੌਲੀ ਹੌਲੀ ਜਿਵੇਂ ਜਿਵੇਂ ਸਮੇਂ ਨੇ ਕਰਵਟ ਲਈ ਬੈਲ ਗੱਡੀਆਂ ਦੀ ਥਾਂ ਮੋਟਰ ਗੱਡੀਆਂ ਆ ਗਈਆਂ ਛੋਟੀਆਂ ਬੱਸਾਂ ਆ ਗਈਆਂ ਉਹਨਾਂ ਨਾਲ ਸਫ਼ਰ ਕਰਨਾ ਸ਼ੁਰੂ ਕਰ ਦਿੱਤਾ ਗਿਆ ਫਿਰ ਉਸ ਤੋਂ ਬਾਅਦ ਸਕੂਟਰ ਮੋਟਰਸਾਈਕਲ ਚੱਲਣ ਲੱਗ ਗਏ ਅਤੇ ਉਹਨਾਂ ਨਾਲ ਅ ਜੀਵਨ ਹੋਰ ਵੀ ਸੌਖਾ ਹੋ ਗਿਆ ਇਸ ਤੋਂ ਇਲਾਵਾ ਫਿਰ ਜਿਵੇਂ ਜਿਵੇਂ ਸਾਇੰਸ ਨੇ ਤਰੱਕੀ ਕੀਤੀ ਅਤੇ ਅ ਕਾਰਾਂ ਜੀਪਾਂ ਅ ਜਿਹੜੀਆਂ ਉਹ ਵਰਤੋਂ ਵਿੱਚ ਆਈਆਂ ਹੁਣ ਤਕਰੀਬਨ ਇਸ ਤਰ੍ਹਾਂ ਦਾ ਸਮਾਂ ਆ ਗਿਆ ਹੈ ਕਿ ਹਰੇਕ ਘਰ ਵਿੱਚ ਕਾਰਾਂ ਟੂ ਵੀਲਰ ਮੋਟਰਸਾਈਕਲ ਸਕੂਟਰ ਵਗੈਰਾ ਆਮ ਹੀ ਹਨ ਅਤੇ ਇਸ ਤੋਂ ਇਲਾਵਾ ਸਾਈਕਲ ਵਗੈਰਾ ਦੀ ਵੀ ਵਰਤੋਂ ਜਿੱਥੇ ਹੁਣ ਵੀ ਕਈ ਲੋਕ ਚਾਹੇ ਸ਼ੌਂਕ ਦੇ ਤੌਰ 'ਤੇ ਚਾਹੇ ਸਿਹਤ ਨੂੰ ਫਿਟ ਰੱਖਣ ਦੇ ਤੌਰ 'ਤੇ ਵਰਤਦੇ ਹਨ ਕਈ ਵਾਰ ਸਵੇਰ ਨੂੰ ਸੈਰ ਵੀ ਸਾਈਕਲ 'ਤੇ ਕਰਦੇ ਹਨ ਜਿਹਦੇ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਆਵਾਜਾਈ ਦਾ ਇਸੇ ਤਰ੍ਹਾਂ ਜਿੱਦਾਂ ਰੇਲ ਗੱਡੀਆਂ ਬਹੁਤ ਰੂਟ ਚੱਲ ਪਏ ਜਿਵੇਂ ਅੱਗੇ ਥੋੜ੍ਹੇ ਰੂਟ ਸਨ ਹੁਣ ਬਹੁਤ ਰੂਟ ਚੱਲ ਪਏ ਵੇ ਦੂਰ ਦੁਰਾਡੇ ਅਤੇ ਬੱਸਾਂ ਦੇ ਰੂਟ ਵੀ ਬਹੁਤ ਲੰਬੇ ਲੰਬੇ ਹੋ ਗਏ ਹਨ ਅਤੇ ਇਸ ਤੋਂ ਇਲਾਵਾ ਫਿਰ ਹਵਾਈ ਜਹਾਜ਼ ਤੱਕ ਇਹ ਸਫ਼ਰ ਬਹੁਤ ਸੌਖੇ ਹੋ ਗਏ ਹਨ ਆਸਾਨ ਹੋ ਗਏ ਹਨ ਜਿਹੜੀਆਂ ਹਜ਼ਾਰਾਂ ਕਰੋੜਾਂ ਮੀਲ ਦੇ ਸਫਰ ਵੀ ਜਿਹੜੇ ਆ ਉਹ ਘੰਟਿਆਂ ਵਿੱਚ ਆ ਗਏ ਅਤੇ ਜਿਹੜਾ ਆਵਾਜਾਈ ਦਾ ਹੁਣ ਬਹੁਤ ਹੀ ਤਰੱਕੀ ਵੱਲ ਸਿਸਟਮ ਸਾਰਾ ਹੀ ਚਲੇ ਗਿਆ ਹੈ